ਜੀ ਹਾਂਜੀ ਅਸੀਂ ਆਪਣੇ ਘਰ ਵਿੱਚ ਪ੍ਰੈਸ਼ਰ ਕੂਕਰ ਵਿੱਚ ਬਹੁਤ ਚੀਜ਼ਾਂ ਬਣਾਉਂਦੇ ਹਨ ਜਿਵੇਂ ਕਿ ਪ੍ਰੈਸ਼ਰ ਕੁੱਕਰ ਵਿੱਚ ਜ਼ਿਆਦਾਤਰ ਤਾਂ ਦਾਲਾਂ ਹੀ ਬਣਾਈਆਂ ਜਾਂਦੀਆਂ ਹਨ ਪਰ ਕੁਝ ਕੁ ਸਬਜ਼ੀਆਂ ਵੀ ਪ੍ਰੈਸ਼ਰ ਕੁਕਰ ਵਿੱਚ ਬਣ ਜਾਂਦੀਆਂ ਹਨ ਖੁੱਲ੍ਹੇ ਭਾਂਡਿਆਂ ਵਿੱਚ ਵੀ ਸਬਜ਼ੀਆਂ ਦਾ ਸਵਾਦ ਵੱਖਰਾ ਹੀ ਆਉਂਦਾ ਹੈ ਜੋ ਚੀਜ਼ਾਂ ਪ੍ਰੈਸ਼ਰ ਕੁੱਕਰ ਵਿੱਚ ਨਹੀਂ ਬਣਦੀਆਂ ਉਹ ਖੁੱਲ੍ਹੇ ਭਾਂਡਿਆਂ ਵਿੱਚ ਬਣਾਈਆਂ ਜਾਂਦੀਆਂ ਹਨ ਪ੍ਰੈਸ਼ਰ ਕੁੱਕਰ ਵਿੱਚ ਜਿਵੇਂ ਕਿ ਸਬਜ਼ੀ ਜਾਂ ਕੋਈ ਦਾਲ ਬਣਾਉਣ ਨੂੰ ਕੁਛ ਕ ਸਮਾਂ ਲੱਗਦਾ ਹੈ ਜਿਵੇਂ ਕਿ ਦਸ ਪੰਦਰ੍ਹਾਂ ਮਿੰਟ ਪਰ ਜੇਕਰ ਆਪਾਂ ਖੁੱਲ੍ਹੇ ਭਾਂਡੇ ਵਿੱਚ ਕੋਈ ਸਬਜ਼ੀ ਬਣਾਈਏ ਜਾਂ ਕੋਈ ਦਾਲ ਬਣਾਈਏ ਉਸ ਨੂੰ ਟਾਈਮ ਲੱਗਦਾ ਹੈ ਦਾਲਾਂ ਜ਼ਿਆਦਾਤਰ ਤਾਂ ਪ੍ਰੈਸ਼ਰ ਕੁੱਕਰ ਵਿੱਚ ਹੀ ਬਣਦੀਆਂ ਹਨ ਜੇ ਆਪਾਂ ਕੋਈ ਦਾਲ ਖੁੱਲ੍ਹੇ ਭਾਂਡੇ ਵਿੱਚ ਬਣਾਈਏ ਤਾਂ ਉਹ ਅੱਧ ਕੱਚੀ ਜਿਵੇਂ ਕਿ ਪੱਕ ਅੱਧੀ ਕ ਪੱਕ ਜਾਂਦੀ ਹੈ ਅਤੇ ਅੱਧੀ ਕੱਚੀ ਰਹਿ ਜਾਂਦੀ ਹੈ ਪ੍ਰੈਸ਼ਰ ਕੁੱਕਰ ਵਿੱਚ ਬਣਾਈਆਂ ਦਾਲਾਂ ਸਬਜ਼ੀਆਂ ਦਾ ਸਵਾਦ ਖੁੱਲ੍ਹੇ ਭਾਂਡਿਆਂ ਵਿੱਚ ਬਣਾਈਆਂ ਸਬਜ਼ੀਆਂ ਜਾਂ ਦਾਲਾਂ ਨਾਲੋਂ ਵੱਖਰਾ ਹੁੰਦਾ ਹੈ ਇਸ ਦਾ ਸਵਾਦ ਵੱਖਰਾ ਹੁੰਦਾ ਹੈ ਅਤੇ ਪ੍ਰੈਸ਼ਰ ਕੁੱਕਰ ਵਿੱਚ ਜ਼ਿਆਦਾਤਰ ਪਾਣੀ ਨਹੀਂ ਸੁੱਕਦਾ ਹੈ ਬਲਕਿ ਖੁੱਲ੍ਹੇ ਭਾਂਡੇ ਵਿੱਚ ਪਾਣੀ ਜੇ ਆਪਾਂ ਪਾਈਏ ਤਾਂ ਉਹ ਸੁੱਕ ਜਾਂਦਾ ਹੈ ਪ੍ਰੈਸ਼ਰ ਕੁੱਕਰ ਵਿੱਚ ਪਾਣੀ ਸਾਨੂੰ ਉਸ ਹਿਸਾਬ ਨਾਲ ਪਾਉਣਾ ਚਾਹੀਦਾ ਹੈ ਜਿੰਨਾ ਕੁ ਅਸੀਂ ਦਾਲਾਂ ਜਾ ਸਬਜ਼ੀਆਂ ਵਿੱਚ ਰੱਖਣਾ ਹੋਵੇ